ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਅਸੀਂ ਗਿਆਨ ਸਾਗਰ ਹੋਸਪਿਟਲ ਤੋਂ ਬੋਲਦੇ ਹਾਂ ਹਾਂਜੀ ਤੁਸੀਂ ਸਾਡੇ ਬਾਰੇ ਸਹੀ ਸੁਣਿਆ ਹੈ ਜੀ ਹਾਂਜੀ ਹਾਂਜੀ ਅਸੀਂ ਜਿਵੇਂ ਕਾਰਵਾਈ ਕਰਦੇ ਅਤੇ ਸਾਡੇ ਪੰਜ ਲੱਖ ਵਾਲੇ ਕਾਰਡ ਜਿਹੜੇ ਸਰਕਾਰ ਨੇ ਬਣਾਏ ਉਹ ਵੀ ਚੱਲ ਜਾਂਦੇ ਨੇ ਜੀ ਇਸਨੇ ਐਮਰਜੰਸੀ ਤੱਕ ਜਾਣਾ ਤੁਹਾਨੂੰ ਸਭ ਤੋਂ ਪਹਿਲਾਂ ਜੀ ਰਿਸੈਪਸ਼ਨ 'ਤੇ ਜਾ ਕੇ ਆਪਣਾ ਇੱਕ ਫੋਮ ਫਿਲ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਅਮਾਊਂਟ ਜਮ੍ਹਾਂ ਕਰਨੀ ਪਵੇਗੀ ਅਤੇ ਉਹਦਾ ਫਿਰ ਉਹ ਐਡਮਿਟ ਹੋ ਸਕਦਾ ਜੀ ਹਾਂਜੀ ਹਾਂਜੀ ਅਸੀਂ ਤੁਹਾਡੀ ਸਹੀ ਸੁਣਿਆ ਹੈ ਜੀ ਅਸੀਂ ਡਿਸਕਾਉਂਟ ਰੇਟਾਂ 'ਤੇ ਟੈਸਟ ਕਰਦੇ ਨੇ ਲੋਕਾਂ ਦੇ ਹਾਂਜੀ ਸਾਡੇ ਮਸ਼ੀਨਾਂ ਸਾਰੀਆਂ ਹੀ ਵਧੀਆ ਮਸ਼ੀਨਾਂ ਨੇ ਅਤੇ ਸਾਡੀ ਰਿਪੋਰਟਾਂ ਪੰਜ ਮਿੰਟਾਂ ਵਿੱਚ ਤਿਆਰ ਹੋ ਜਾਂਦੀਆਂ ਨੇ ਜੀ ਨਹੀਂ ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਰਿਪੋਰਟਾਂ ਪੰਜ ਮਿੰਟਾਂ ਵਿੱਚ ਆ ਜਾਂਦੀਆ ਸਾਡੀ ਨਵੀਂ ਮਸ਼ੀਨਾਂ ਸਾਰੀਆਂ ਸਾਰੀਆਂ ਇੰਮਪੋਰਟੈਂਟ ਮਸ਼ੀਨਾਂ ਨੇ ਤਾਂ ਹੀ ਸਾਡੀਆਂ ਰਿਪੋਰਟਾਂ ਜਲਦੀ ਆ ਜਾਂਦੀਆਂ ਨੇ ਅਤੇ ਸਹੀ ਹੁੰਦੀਆਂ ਨੇ ਅਤੇ ਸਹੀ ਹੁੰਦੀਆਂ ਨੇ ਸਾਰੀਆਂ ਜੀ ਹਾਂਜੀ ਹਾਂਜੀ ਸਾਡੀ ਪੂਰੀ ਰਿਪੋਰਟਾਂ ਓਕੇ ਮਿਲਣਗੀਆਂ ਤੁਹਾਨੂੰ ਜੀ ਜੀ ਓਹ ਉਹਨਾਂ ਦੇ ਇੱਕ ਦਿਨ ਦਾ ਖਰਚਾ ਹੈ ਇੱਕ ਹਜ਼ਾਰ ਰੁਪਏ ਪੈ ਜਾਂਦਾ ਅਤੇ ਜੇ ਕਿਸੀ ਨੇ ਪ੍ਰਾਈਵੇਟ ਹੋਵੇ ਤਾਂ ਉਹਦਾ ਤਿੰਨ ਹਜ਼ਾਰ ਰੁਪਏ ਇੱਕ ਦਿਨ ਦਾ ਖਰਚਾ ਪੈ ਜਾਂਦਾ ਜੀ ਹਾਂਜੀ ਹਾਂਜੀ ਸਾਨੂੰ ਇਹ ਸਾਰੇ ਕਾਰਡ ਚੱਲ ਜਾਣਗੇ ਨੂੰ ਰੀਸੈਪਸ਼ਨ 'ਤੇ ਫੋਮ ਫਿਲ ਕਰਨੇ ਪੈਣੇ ਇਹਦੇ ਰਿਗਾਰਡਿੰਗ ਅਤੇ ਨਾਲ ਹੀ ਤੁਹਾਨੂੰ ਬਿਲ ਵਗੈਰਾ ਕੱਟ ਕੇ ਤਾਂ ਨਾਲ ਦੇ ਦਿੱਤਾ ਜਾਵੇਗਾ ਸਾਰਾ ਕੁਛ ਨਹੀਂ ਤੁਸੀਂ ਨਾ ਐਡਮਿਸ਼ਨ ਦੇ ਟਾਈਮ 'ਤੇ ਸਾਰਾ ਉਹਨਾਂ ਨੂੰ ਦੱਸ ਦੇਣਾ ਨਾ ਕਿ ਤੁਹਾਡੇ ਕੋਲ ਕਿਹੜੀ ਕੰਪਨੀ ਦਾ ਕਾਰਡ ਹੈ ਅਤੇ ਤੁਹਾਨੂੰ ਉਸ ਉਸੇ ਟਾਈਮ 'ਤੇ ਹੀ ਦੱਸ ਦੇਣਗੇ ਕਿ ਹਾਂ ਵੀ ਤੁਹਾਡਾ ਕਾਰਡ ਵੈਰੀ ਵੈਲਿਡ ਹੈ ਕਿ ਨਹੀਂ ਹੈਗਾ ਜੇ ਵੈਲਿਡ ਹੋਵੇਗਾ ਤਾਂ ਤੁਹਾਨੂੰ ਦੱਸ ਦੇਣਗੇ ਹਾਂ ਵੀ ਤੁਹਾਡਾ ਸਾਰਾ ਖਰਚਾ ਇਹ ਕਾਰਡ ਦੇ ਰਾਹੀਂ ਹੋ ਜਾਵੇਗਾ ਅਤੇ ਨਹੀਂ ਨਹੀਂ ਹੋਵੇਗਾ ਤਾਂ ਤੁਹਾਨੂੰ ਦੱਸ ਦੇਣਗੇ ਇਹਦੇ ਵਿੱਚ ਕੀ ਕਮੀ ਹੈ ਅਤੇ ਉਹ ਤੁਸੀਂ ਸਹੀ ਕਰਾ ਕੇ ਆਪਣਾ ਇਲਾਜ ਕਰਾ ਸਕਦੇ ਹੋ ਹਾਂਜੀ ਤੁਸੀਂ ਇੱਦਾਂ ਕਹਿਣ ਦੇ ਵਿੱਚ ਇਹਦੇ ਲਈ ਤੁਸੀਂ ਗਿਆਨ ਸਾਗਰ ਦੀ ਵੈਬਸਾਈਟ ਹੈਗੀ ਆ ਉਹਦੇ 'ਤੇ ਜਾ ਕੇ ਤੁਸੀਂ ਜਾਂ ਤੁਹਾਨੂੰ ਗੂਗਲ 'ਤੇ ਜਾ ਕੇ ਬੁੱਕ ਕਰਨਾ ਪੈਣਾ ਰੂਮ ਹਾਂਜੀ ਸਰ

ਛੱਬੀ ਸੌ ਰੁਪਏ ਦਾ ਤੁਹਾਨੂੰ ਪਵੇਗਾ ਇਹਦੇ ਵਿੱਚ ਤੁਹਾਡੇ ਸਾਰੇ ਟੈਸਟ ਹੋ ਜਾਣਗੇ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡੇ ਬ ਬਲੱਡ ਕਿੰਨਾ ਸ਼ੂਗਰ ਕਿੰਨੀ ਹੈ ਬਲੱਡ ਦੇ ਵਿੱਚ ਡੀਪ ਸੀ ਦੀ ਕਮੀ ਤਾਂ ਨਹੀਂ ਹੋਈ ਹੈਗੀ ਅਤੇ ਤੁਹਾਡੀ ਸਾਰੇ ਕੈਰੇਟੀਨ ਵਗੈਰਾ ਬਲੱਡ ਸੈੱਲ ਬਲੱਡ ਯੂਰੀਨ ਵਗੈਰਾ ਸਾਰਾ ਕੁਛ ਦਾ ਟੈਸਟ ਹੋ ਜਾਂਦਾ ਤੁਹਾਡੇ ਜੀ ਜੀ ਸਰ ਅਸੀਂ ਉਹਨਾਂ ਨੂੰ ਮਾਨ ਕਰ ਦਿੰਦੇ ਨੇ ਅਤੇ ਉਹਨਾਂ ਦਾ ਅਸੀਂ ਕਰ ਦਿੰਦੇ ਨੇ ਰਿਆਇਤ ਵਗੈਰਾ ਦੇ ਦਿੰਦੇ ਜਿਹੜਾ ਗਰੀਬ ਪਰਿਵਾਰ ਨਾਲ ਸੰਬਧਿਤ ਹੁੰਦਾ ਹੈ ਉਹਨੂੰ ਅਸੀਂ ਕਰ ਦਿੰਦੇ ਨੇ ਘੱਟ ਕਰ ਕਰਾ ਦਿੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਜੀ ਸਦਕੇ ਆਓ ਜੀ ਹਾਂਜੀ ਹਾਂਜੀ ਜ਼ਰੂਰ ਇਸ ਨੰਬਰ 'ਤੇ ਤੁਸੀਂ ਕਾਲ ਕਰ ਲਿਓ ਧੰਨਵਾਦ ਧੰਨਵਾਦ ਮੈਮ ਧੰਨਵਾਦ